ਜੇ ਸਥਾਨਕ ਖੇਡਾਂ ਦੀ ਗੱਲ ਕਰੀਏ ਇੰਡੋਰ ਤੋਂ ਵੀ ਅੱਡ ਜੇ ਆਪਾਂ ਗੱਲ ਕਰੀਏ ਤਾਂ ਸਥਾਨਕ ਰੂਪ ਤੋਂ ਪੰਜਾਬ ਦੇ ਵਿੱਚ ਕਬੱਡੀ ਖੋ ਖੋ ਕੁਸ਼ਤੀ ਇਹ ਸਭ ਖੇਡਾਂ ਪੰਜਾਬ ਅਤੇ ਹਰਿਆਣੇ ਦੇ ਲਾਗੇ ਨੋਰਥ ਵੈਸਟ ਹਿੱਸੇ ਵਿੱਚ ਹੁੰਦੀ ਰਹੀਆਂ ਪਰ ਜਿਓਂ ਤਿਓਂ ਜਿਵੇਂ ਮੌਸਮ ਦੀ ਅਨੁਕੂਲਤਾ ਨਾ ਹੋਣ ਕਰਕੇ ਜਾਂ ਕਾਫ਼ੀ ਹੋਰ ਫੈਕਟਰਸ ਕਰਕੇ ਕੁਝ ਇੰਡੋਰ ਖੇਲ੍ਹ ਵੀ ਡਿਵੈਲਪ ਹੋਏ ਜਿਵੇਂ ਉਹਨਾਂ ਚੋਂ ਜੇ ਭਾਰਤ ਦੇ ਆਪਣੇ ਖੇਲ੍ਹ ਦੇਖੀਏ ਤਾਂ ਉਹਨਾਂ ਵਿੱਚੋਂ ਲੂਡੋ ਵੀ ਹੈ ਅਤੇ ਲੂਡੋ ਵੀ ਹੈ ਅਤੇ ਜਿਵੇਂ ਦੋ ਹੋਰ ਵੀ ਵਿਦੇਸ਼ੀ ਜਿਵੇਂ ਦੇਸ਼ਾਂ ਦਾ ਪ੍ਰਭਾਵ ਕਲਚਰਲ ਇੰਮਪੈਕਟ ਹੋਣ ਕਰਕੇ ਅਤੇ ਦੂਜੇ ਵੀ ਖੇਡ ਆਏ ਜਿਵੇਂ ਕਿਆਰਮ ਕੈਰਮ ਹੈ ਅਤੇ ਸ਼ਤਰੰਜ ਵੀ ਭਾਰਤ ਦਾ ਇੱਕ ਆਪਣਾ ਹੀ ਖੇਈ ਹੈ ਸੱਪ ਅਤੇ ਸੀੜੀ ਵੀ ਸੱਪਸੀੜੀ ਵੀ ਹੈ ਜਿਹੜੀ ਇਹ ਖੇਈਹ ਹੁਣ ਡਿਜੀਟਲ ਵੀ ਹੁੰਦੇ ਆਏ ਆ ਜਿਵੇਂ ਪਹਿਲਾਂ ਇਹ ਆਪਾਂ ਫਿਜਿਕਲੀ ਖੇਈਦੇ ਸੀ ਜਿਵੇਂ ਬੋਰਡ ਗੇਮ ਸੀ ਉਹਨਾਂ ਦਾ ਇੱਕ ਬੋਰਡ ਸੀ ਪਰ ਹੁਣ ਇਹ ਡਿਜਿਟਲਾਈਜ ਵੀ ਹੋਣ ਲੱਗੇ ਹੈ ਅਤੇ ਇੰਡੋਰ ਗੇਮਸ ਤਾਂ ਹੁਣ ਇੱਕ ਇੰਪੈਕਟ ਵਧਿਆ ਜਿਵੇਂ ਮੋ ਮੋਬਾਈਲ ਗੇਮਿੰਗ ਹੈ ਕੰਪਿਊਟਰ ਗੇਮਿੰਗ ਹੈ ਜਿਓਂ ਜਿਓਂ ਜਨਰੇਸ਼ਨ ਤਿਓਂ ਤਿਓਂ ਅੱਗੇ ਵੜਦੀ ਹੈ ਉਸ ਹਿਸਾਬ ਨਾਲ ਅਤੇ ਹਰਿਆਣੇ ਦੇ ਅਤੇ ਪੰਜਾਬ ਦੇ ਇਸ ਹਿੱਸੇ ਵਿੱਚ ਵੇਖੀਏ ਤਾਂ ਪੁਰਾਣੀ ਬਜ਼ੁਰਗਾਂ ਨੂੰ ਜਿਹੜੇ ਕਿ ਉਹ ਖੇਡ ਖੇਡਦੇ ਹੁੰਦੇ ਸੀ ਉਹਨੂੰ ਚੋਪੜ ਪਾਸਾ ਕਹਿੰਦੇ ਸੀ ਉਹਦੇ ਵਿੱਚ ਜਿਹੜੀ ਸੀ ਸ਼ੈਲ ਹੈ ਜਿਹੜੀ ਸਮੁੰਦਰ ਤੋਂ ਨਿਕਲਣ ਵਾਲੇ ਸ਼ੈਲ ਹੈ ਅਤੇ ਉਹ ਕੱਪੜੇ 'ਤੇ ਜਿਵੇਂ ਅੱਜ ਦਾ ਸ਼ਤਰੰਜ ਹੈ ਜਿਵੇਂ ਅੱਜ ਦਾ ਸੱਪ ਸੀੜੀ ਆ ਉਸ ਵਰਗਾ ਹੀ ਉਸ ਤੋਂ ਪਹਿਲਾਂ ਇੱਕ ਪੁਰਾਤਨ ਖੇਡ ਹੈ ਜਿਹੜਾ ਮਹਾਂਭਾਰਤ ਦੇ ਸਮੇਂ ਤੋਂ ਵੀ ਖੇਡਿਆ ਜਾਂਦਾ ਇੰਡੋਰ ਗੇਮ ਗੇਮਸ ਦੇ ਵਿੱਚੋਂ ਇੱਕ ਆਉਂਦਾ ਉਹ ਗੇਮ ਹੈ ਅਤੇ ਉਹਦੇ ਵਿੱਚ ਚਾਰ ਜਣੇ ਇੱਕ ਸਾਥ ਖੇਡ ਸਕਦੇ ਅਤੇ ਚਾਰ ਅਤੇ ਉਹਦੇ ਵਿੱਚ ਵੀ ਨੰਬਰਸ ਹੁੰਦੇ ਆ ਸੰਖਿਆਵਾਂ ਹੁੰਦੀਆਂ ਅਤੇ ਉਹਨਾਂ ਸੰਖਿਆਵਾਂ ਨਾਲ ਉਹਨਾਂ ਦੇ ਜੋੜ ਅਤੇ ਤੋੜ ਨਾਲ ਉਹ ਉਹ ਜਿਹੜਾ ਉਹਨਾਂ ਦਾ ਪਿਆਦਾ ਅੱਗੇ ਵੱਧਦਾ ਹੈ ਅਤੇ ਪਿੱਛੇ ਆਉਂਦਾ ਇਸ ਹਿਸਾਬ ਨਾਲ ਕਈ ਤਰੀਕੇ ਦੀ ਖੇਡ ਆ ਜਿਹੜੇ ਹਲੇ ਵੀ ਲੋਕ ਖੇਡਦੇ ਹੈ